ਹਾਂਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਹਿਬ ਢਾਬੇ ਤੋਂ ਬੋਲਦੇ ਜੀ ਹਾਂਜੀ ਸਾਹਿਬ ਮੈਂ ਹਰਦੀਪ ਸਿੰਘ ਬੋਲ ਰਿਹਾ ਅਤੇ ਅਤੇ ਤੁਹਾਡੇ ਢਾਬੇ ਤੋਂ ਅੱਗੇ ਵੀ ਔਡਰ ਕੀਤਾ ਸੀ ਅਤੇ ਉਸ ਦੇ ਨਾਲ ਤੁਸੀਂ ਕਿਹੜਾ ਇਹ ਕੂਪਨ ਵੀ ਦਿੱਤਾ ਸੀਗਾ ਵੀ ਜੇ ਤੁਸੀਂ ਅੱਗੇ ਨੈਕਸਟ ਔਡਰ ਕਰਦੇ ਆ ਤਾਂ ਜਿਹੜਾ ਤੁਹਾਨੂੰ ਚਾਲੀ ਪ੍ਰਸੈਂਟ ਜਿਹੜੀ ਉਹ ਤੁਸੀਂ ਛੋਟ ਦਿਉਗੇ ਜੀ ਹਾਂਜੀ ਹਾਂਜੀ ਹਾਂਜੀ ਹਾਂ ਇਸ ਵਾਰ ਵੀ ਔਡਰ ਕਰਨਾ ਚਾਹੁੰਦੇ ਹਾਂ ਜੀ ਅਤੇ ਔਡਰ ਦੇ ਵਿੱਚ ਲਿਖ ਲਉ ਇੱਕ ਤਾਂ ਤੁਸੀਂ ਸ਼ਾਹੀ ਪਨੀਰ ਦੇ ਦਿਉ ਦਾਲ ਮੱਖਣੀ ਹੋ ਗਈ ਜੀ ਅਤੇ ਜਾਂ ਤੁਸੀਂ ਨਾਲ ਠੀਕ ਆ ਮਿਕਸ ਵੈੱਗਜ ਦੇ ਦਿਉ ਅਤੇ ਰਾਇਤਾ ਹਾਂ ਰਾਇਤਾ ਵੀ ਜ਼ਰੂਰ ਦੇ ਦਿਉ ਅਤੇ ਇਹ ਤੁਸੀਂ ਦੇਖ ਲਉ ਬਈ ਉਸ ਹਿਸਾਬ ਨਾਲ ਹਾਂ ਸਵੀਟਸ ਵੀ ਦੇ ਦਿਉ ਕੁਛ ਹਾਂ ਜੋ ਵੀ ਹਾਂ ਆਈਸ ਕ੍ਰੀਮ ਭੇਜ ਦਿਉ ਅਤੇ ਏਜ ਹੁਣ ਫਿਰ ਇਸ ਹਿਸਾਬ ਨਾਲ ਕਿੰਨੇ ਬਣਨਗੇ ਇਹ ਵੀ ਦੱਸ ਦੇਣਾ ਜੀ ਮੈਨੂੰ ਜਿਹੜੀ ਪੇਮੈਂਟ ਹੈ ਉਹ ਜਿੱਦਾਂ ਤੁਸੀਂ ਕਹੋਗੇ ਅਸੀਂ ਉਸ ਹਿਸਾਬ ਨਾਲ ਕਰ ਸਕਦੇ ਹਾਂ ਕੈਸ਼ ਲੈਣੀ ਕੈਸ਼ ਵੀ ਅਤੇ ਔਡਰ ਭੇਜ ਦਿਉ ਅਤੇ ਚਾਹੇ ਜੇ ਤੁਸੀਂ ਕਹੋਗੇ ਵੀ ਔਨਲਾਈਨ ਪੇਮੈਂਟ ਕਰਨੀ ਆ ਤਾਂ ਔਨਲਾਈਨ ਵੀ ਕਰ ਦਿੰਦਾ ਇਹ ਮੈਨੂੰ ਬਸ ਦੱਸ ਦਿਉ ਵੀ ਜਿਹੜੀ ਹੁਣ ਪੇਮੈਂਟ ਕਿੰਨੀ ਬਣਨੀ ਹੈ ਕਿਉਂਕਿ ਤੁਸੀਂ ਕਿਹਾ ਸੀ ਨਾ ਵੀ ਅਗਲੀ ਵਾਰ ਜਿਹੜਾ ਇਹ ਚਾਲੀ ਪ੍ਰਸੈਂਟ ਛੋਟ ਹੋਏਗੀ ਅਤੇ ਉਸ ਹਿਸਾਬ ਨਾਲ ਬਣਾ ਕੇ ਮੈਨੂੰ ਦੱਸ ਦਿਉ ਮੈਂ ਦੋਨੋਂ ਤਰ੍ਹਾਂ ਜਿਹੜੀ ਪੇਮੈਂਟ ਕਰ ਸਕਦਾ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖਾਣਾ ਤੁਹਾਡਾ ਵਧੀਆ ਹੁੰਦਾ ਅੱਗੇ ਵੀ ਅਸੀਂ ਜਦ ਵੀ ਔਡਰ ਕਰਦੇ ਹਾਂ ਤਾਂ ਬੇਸ਼ੱਕ ਤੁਸੀਂ ਜਿਹੜੀ ਛੂਟ ਨਹੀਂ ਵੀ ਦਿੰਦੇ ਤਾਂ ਵੀ ਅਸੀਂ ਇੱਕ ਇੱਥੋਂ ਹੀ ਕਰਨਾ ਸੀਗਾ ਠੀਕ ਆ ਜੇ ਛੋਟ ਤੁਸੀਂ ਕੂਪਨ ਮੈਨੂੰ ਆਇਆ ਹੋਇਆ ਤਾਂ ਕੂਪਨ ਮੈਂ ਤੁਹਾਨੂੰ ਦੇ ਵੀ ਭੇਜ ਵੀ ਦਿੰਦਾ ਜਿੱਦਾਂ ਤੁਸੀਂ ਕਹਿੰਦੇ ਆ ਜਾਂ ਤੁਹਾਡੇ ਡਿਲੀਵਵਰੀ ਬੋਆਏ ਨੂੰ ਦੇ ਦੂੰਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭੇਜ ਦਿਉ ਜੀ ਥੈਂਕ ਯੂ